ਜਿਵੇਂ ਜਿਵੇਂ ਸਾਡਾ ਦੇਸ਼ ਵਿਕਸਿਤ ਹੁੰਦਾ ਜਾ ਰਿਹਾ ਹੈ ਉਵੇਂ ਹੀ ਔਰਤਾਂ ਦੇ ਸਿੱਖਿਆ ਦਾ ਪੱਧਰ ਵੀ ਉੱਚਾ ਹੁੰਦਾ ਜਾ ਰਿਹਾ ਹੈ ਕੋਈ ਵੀ ਅਜਿਹਾ ਪਿੰਡ ਨਹੀਂ ਹੋਏਗਾ ਜਿੱਥੇ ਔਰਤਾਂ ਨੂੰ ਸਿੱਖਿਆ ਨਾ ਮਿਲਦੀ ਹੋਵੇ ਅਤੇ ਜਿੱਥੇ ਔਰਤਾਂ ਦੇ ਹੱਕ ਦੇ ਲਈ ਕੋਈ ਖੜ੍ਹਦਾ ਨਾ ਹੋਵੇ ਪਰ ਮੈਂ ਇੱਕ ਸੰਸਥਾ ਬਾਰੇ ਜਾਣਦੀ ਹਾਂ ਜੋ ਕਿ ਸਾਡੇ ਸ਼ਹਿਰ ਪਟਿਆਲੇ ਦੇ ਵਿੱਚ ਹੀ ਹੈ ਔਰਤਾਂ ਦੇ ਲਈ ਹੀ ਹਰ ਵਾਰੀ ਉਹ ਖੜ੍ਹਦੀ ਹੈ ਔਰਤਾਂ ਦੇ ਵਿਰੁੱਧ ਜੇ ਕੋਈ ਕਦਮ ਚੁੱਕਦਾ ਤਾਂ ਉਹਦੇ ਹੱਕ ਵਿੱਚ ਲੜਦੀ ਹੈ ਸੋ ਇਸ ਸੰਸਥਾ ਦਾ ਨਾਮ ਹੈ ਮਹਿਲਾ ਮੰਡਲ ਸੋ ਇਸ ਮਹਿਲਾ ਮੰਡਲ ਦਾ ਮੈਂ ਵੀ ਇੱਕ ਹਿੱਸਾ ਹਾਂ ਮੈਂ ਵੀ ਜਦੋਂ ਫ੍ਰੀ ਹੋਵਾਂ ਵਿਹਲੀ ਹੋਵਾਂ ਜਿੱਦਣ ਛੁੱਟੀ ਵਾਲੇ ਦਿਨ ਮੈਂ ਮਹਿਲਾ ਮੰਡਲ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਸਹਾਇਤਾ ਕਰਾਉਂਦੀ ਹਾਂ ਉਹਨਾਂ ਦੀ ਕਈ ਤਰ੍ਹਾਂ ਦੇ ਕੇਸ ਸਾਨੂੰ ਦੇਖਣ ਨੂੰ ਮਿਲਦੇ ਨੇ ਕਿ ਔਰਤਾਂ ਦੇ ਉੱਤੇ ਬਦਸਲੂਕੀ ਕੀਤੀ ਜਾਂਦੀ ਹੈ ਜਦੋਂ ਘਰ ਦੇ ਵਿੱਚ ਬਿਨਾਂ ਮਤਲਬ ਤੋਂ ਉਹਨਾਂ ਨੂੰ ਉਹਨਾਂ ਨਾਲ ਲੜਾਈ ਕੀਤੀ ਜਾਂਦੀ ਆ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਅਤੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਜਾਂ ਫਿਰ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਪਾਈ ਜਾਂਦੀ ਹੈ ਕਈ ਤਰ੍ਹਾਂ ਦੇ ਇਹੋ ਜਿਹੇ ਕੇਸ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਮਹਿਲਾ ਮੰਡਲ ਕਾਰਵਾਈ ਕਰਦੀ ਹੈ ਅਤੇ ਇਹ ਸੰਸਥਾ ਅਨਪੜ੍ਹ ਮਹਿਲਾਵਾਂ ਨੂੰ ਸਿੱਖਿਆ ਵੀ ਪ੍ਰਦਾਨ ਕਰਦੀ ਹੈ ਕਈ ਮਹਿਲਾਵਾਂ ਹਨ ਜੋ ਪੜ੍ਹਨਾ ਚਾਹੁੰਦੀਆਂ ਨੇ ਪਰ ਉਹਨਾਂ ਦਾ ਵਿਆਹ ਹੋ ਚੁੱਕਿਆ ਬੱਚੇ ਹੋ ਚੁੱਕੇ ਨੇ ਪਰ ਅੱਗੇ ਉਹ ਹੁਣ ਨਹੀਂ ਜਾ ਰਹੀਆਂ ਕਿਤੇ ਸੋ ਉਹਨਾਂ ਨੂੰ ਅਸੀਂ ਦੋ ਘੰਟੇ ਇਸ ਸੰਸਥਾ ਦੇ ਵਿੱਚ ਬੁਲਾ ਕੇ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ ਜੋ ਵੀ ਉਹਨਾਂ ਦੇ ਕੰਮ ਦੇ ਲਈ ਕੋਈ ਕੰਮ ਹੁੰਦਾ ਜਾਂ ਫਿਰ ਰੁਜ਼ਗਾਰ ਹੁੰਦਾ ਅਸੀਂ ਉਹਨਾਂ ਨੂੰ ਉਹ ਮੌਕੇ ਵੀ ਪ੍ਰਦਾਨ ਕਰਦੇ ਹਾਂ ਜਿਹਨਾਂ ਮਹਿਲਾਵਾਂ ਨੂੰ ਕੋਈ ਕੰਮ ਦੀ ਲੋੜ ਹੁੰਦੀ ਹੈ ਅਸੀਂ ਉਹਨਾਂ ਦੀ ਸਹਾਇਤਾ ਵੀ ਕਰਦੇ ਹਾਂ ਜਿਵੇਂ ਕਿ ਕਈਆਂ ਦੇ ਵਿੱਚ ਹੁਨਰ ਹੁੰਦੇ ਨੇ ਜਿਵੇਂ ਸਿਲਾਈ ਕਰਨਾ ਕਢਾਈ ਕਰਨਾ ਹੋਰ ਵੀ ਕਈ ਤਰ੍ਹਾਂ ਦਾ ਹੁਨਰ ਸੋ ਉਹਨਾਂ ਨੂੰ ਅਸੀਂ ਅਜਿਹੇ ਹੀ ਕੰਮ ਲੱਭ ਕੇ ਦਿੰਦੇ ਹਾਂ ਕਿ ਜੋ ਉਹ ਕਰ ਸਕਣ ਅਤੇ ਆਪਣਾ ਘਰ ਦਾ ਰੁਜ਼ਗਾਰ ਚਲਾ ਸਕਣ ਅਤੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ